ਮੈਂ ਆਪਣੇ ਨੌਕਰੀ ਅਤੇ ਕਰੀਅਰ ਨੂੰ ਲੈ ਕੇ ਇਨ ਫਿਊਚਰ ਲਈ ਬਹੁਤ ਹੀ ਜ਼ਿਆਦਾ ਸੀਰੀਅਸ ਹਾਂ ਤਾਂ ਕਿ ਇਨ ਫਿਊਚਰ ਜਾ ਕੇ ਮੈਨੂੰ ਕੋਈ ਵੀ ਕਮਾਉਣ 'ਚ ਜਾਂ ਐਸ਼ ਕਰਨ 'ਚ ਕੋਈ ਵੀ ਦਿੱਕਤ ਨਾ ਆਵੇ ਇਸ ਕਰਕੇ ਮੈਂ ਟੈਕਨੋਲਜੀਜ਼ ਦਾ ਕੰਮ ਜ਼ਿਆਦਾ ਸਿੱਖਣਾ ਚਾਹੁੰਦੀ ਹਾਂ ਕਿਉਂਕਿ ਅੱਜ ਕੱਲ੍ਹ ਜੋ ਵੀ ਕੰਮ ਆ ਐਵਰੀਥਿੰਗ ਇੱਜ਼ ਡਿਪੈਂਡ ਔਨ ਟੈਕਨੋਲਜੀ ਹਰ ਇੱਕ ਕੰਮ ਸ਼ੋਸ਼ਲ ਮੀਡੀਆ ਰਾਹੀਂ ਹੀ ਜਾ ਰਿਹਾ ਆ ਅਤੇ ਸੋਸ਼ਲ ਮੀਡੀਆ ਰਾਹੀਂ ਇੰਨਾਂ ਜ਼ਿਆਦਾ ਪੈਸਾ ਬਣ ਰਿਹਾ ਹੈ ਲੋਕਾਂ ਨੂੰ ਕਿ ਹਰ ਇੱਕ ਵਰਕ ਜਿਹੜਾ ਹੈ ਡਿਪੈਂਡ ਆ ਸਕੂਲਜ਼ ਦਾ ਕੰਮ ਲਾ ਲਉ ਕਿਸੇ ਵੀ ਵਰਕਸ਼ੌਪ ਦਾ ਕੰਮ ਲਾ ਲਓ ਸਾਰਾ ਕੁਛ ਹੈ ਜੋ ਵੀ ਉਹ ਟੈਕਨੋਲੋਜੀ ਦੇ ਰਾਹੀਂ ਹੀ ਹੋ ਰਿਹਾ ਕਿਸੇ ਨੂੰ ਕੋਈ ਇਨਫੋਮੇਸ਼ਨ ਸੈਂਡ ਕਰਨੀ ਹੈ ਕਿਸੇ ਤੋਂ ਕੁਛ ਮੰਗਵਾਉਣਾ ਆ ਉਹ ਸਭ ਕੁਛ ਇੱਕ ਟੈਕਨੋਲੋਜੀ ਦੇ ਹੀ ਰਾਹੀਂ ਹੋ ਰਿਹਾ ਤਾਂ ਮੈਂ ਚਾਹੁੰਦੀ ਹਾਂ ਉਹ ਕੰਮ ਮੈਂ ਸਿੱਖ ਕੇ ਇਨ ਫਿਊਚਰ ਉਹਨੂੰ ਐਕਸਟੈਂਡ ਕਰਾਂ ਅਤੇ ਮੈਂ ਆਪਣੇ ਹੱਥਾਂ 'ਚ ਲੈ ਕੇ ਆਵਾਂ ਤਾਂ ਕਿ ਮੈਂ ਉਹਦਾ ਦੁੱਗਣਾ ਪੈਸਾ ਕਮਾ ਸਕਾਂ